ਆਮ ਜੁਕਾਮ ਦੇ ਇਲਾਜ ਲਈ ਸਾਡੇ ਪਿੰਡ ਵਿੱਚ ਕਈ ਪ੍ਰਸਿੱਧ ਘਰੇਲੂ ਉਪਚਾਰ ਹਨ ਸਭ ਤੋਂ ਆਮ ਉਪਾਅ ਤਾਂ ਇਸਦਾ ਇਹ ਹੈ ਕਿ ਚਾਹ ਦੇ ਵਿੱਚ ਤੁਲਸੀ ਲੌਂਗ ਇਲਾਚੀ ਅਦਰਕ ਪਾ ਕੇ ਪੀਓ ਜੋ ਸਰੀਰ ਨੂੰ ਗਰਮੀ ਵਿੱਚ ਗਰਮੀ ਪੈਦਾ ਕਰਦੇ ਹਨ ਤੇ ਜੁਕਾਮ ਦੇ ਨਾਲ ਜੋ ਬੈਕਟੀਰੀਆ ਪੈਦਾ ਹੁੰਦੇ ਹਨ ਉਸ ਨੂੰ ਖਤਮ ਕਰਦੇ ਤੇ ਗਲੇ ਨੂੰ ਵੀ ਸਾਫ ਕਰ ਕਰਦੇ ਹਨ ਤੇ ਉਸ ਤੋਂ ਬਾਅਦ ਸਿਰ ਤੋਂ ਪਲਾਟੀ ਚੂਰਨ ਜੋ ਸ਼ਹਿਦ ਦੇ ਵਿੱਚ ਪਾ ਕੇ ਘੋਲ ਕੇ ਖਾਈਦਾ ਹੁੰਦਾ ਹੈ ਜਿਸ ਨਾਲ ਜੁਕਾਮ ਤੋਂ ਰਾਹਤ ਮਿਲਦੀ ਹੈ ਉਸ ਤੋਂ ਬਾਅਦ ਅਨੁਸ਼ਕਾ ਮਟੀ ਦਾ ਕਾੜਾ ਬਣਾ ਕੇ ਪੀਓ ਜਿਸ ਨਾਲ ਜੁਕਾਮ ਠੀਕ ਹੋ ਜਾਂਦਾ ਹੈ ਬੇਸਨ ਦੀ ਲੇਟੀ ਜੋ ਘਰਾਂ ਵਿੱਚ ਆਮ ਬੇਸਨ ਪਾਇਆ ਜਾਂਦਾ ਹੈ ਉਸ ਦੀ ਲੇਟੀ ਬਣਾਓ ਗੁੜ ਸ਼ੱਕਰ ਪਾ ਕੇ ਕੜਾਹ ਦੀ ਤਰਹਾਂ ਬਣਦੀ ਹੈ ਲੇਟੀ ਲੇਟੀ ਬਣਾਓਗੇ ਲੇਟੀ ਬਣਾ ਕੇ ਖਾਓ ਉਸ ਨਾਲ ਵੀ ਜੁਕਾਮ ਤੋਂ ਰਾਹਤ ਮਿਲਦੀ ਹੈ ਤੇ ਉਸ ਤੋਂ ਬਾਅਦ ਦੁੱਧ ਦੇ ਵਿੱਚ ਰਾਤੀ ਸੋਣ ਵੇਲੇ ਦੁੱਧ ਦੇ ਵਿੱਚ ਕਾਲੀ ਮਿਰਚ ਪਾ ਕੇ ਪੀਓ ਇਸ ਨਾਲ ਜੁਕਾਮ ਤੋਂ ਰਾਹਤ ਮਿਲਦੀ ਹੈ ਤੇ ਉਸ ਤੋਂ ਬਾਅਦ ਸੋਣ ਵੇਲੇ ਆਪਾਂ ਆਪਣੇ ਛਾਤੀ ਤੇ ਨੱਕ ਤੇ ਵਿਕਸ ਲਗਾ ਕੇ ਸੋਵਾਂਗੇ ਜਿਸ ਨਾਲ ਜੁਕਾਮ ਠੀਕ ਹੋ ਜਾਂਦਾ ਹੈ ਸਾਰੇ ਆਪਣੀਆਂ ਨਸਾਂ ਖੁੱਲ ਜਾਂਦੀਆਂ ਹਨ ਤੇ ਆਪਾਂ ਨੂੰ ਆਰਾਮ ਮਿਲਦਾ ਹੈ ਇਹ ਸਾਰੇ ਜੁਕਾਮ ਦੇ ਇਲਾਜ ਲਈ ਘਰੇਲੂ ਉਪਾਵ ਹਨ ਜੋ ਪਿੰਡਾਂ ਵਿੱਚ ਦੇਸੀ ਲੋਕ ਆਮ ਵਰਤਦੇ ਹਨ